ਪੰਦਰ੍ਹਾਂ ਸਤੰਬਰ ਉੱਨੀ ਸੌ ਛਿਹੱਤਰ ਦੋ ਅਕਤੂਬਰ ਉੱਨੀ ਸੌ ਉਣਾਸੀ ਚੌਵੀ ਫਰਵਰੀ ਦੋ ਹਜ਼ਾਰ ਛੇ ਸੋਲ੍ਹਾਂ ਅਗਸਤ ਦੋ ਹਜ਼ਾਰ ਚੌਦ੍ਹਾਂ ਉਨੱਤੀ ਮਈ ਦੋ ਹਜ਼ਾਰ ਪੰਜ